ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਰਾਹੁਲ ਨੇ ਮੈਨੂੰ ਤੁਹਾਡਾ ਕੰਟੈਕਟ ਦਿੱਤਾ ਸੀਗਾ ਅਤੇ ਮੈਂ ਨਾ ਐੱਸ ਬੀ ਆਈ ਬੈਂਕ ਪਠਾਨਕੋਟ ਕੰਮ ਕਰਦਾ ਅਤੇ ਮੇਰੀ ਪੋਸਟਿੰਗ ਹਾਂਜੀ ਹਾਂਜੀ ਦਿੱਲੀ ਤੋਂ ਤੁਸੀਂ ਜਾਣਦੇ ਹੋ ਨਾ ਰਾਹੁਲ ਨੂੰ ਐ ਕਲੋਨੀ ਰਹਿੰਦਾ ਤੁਹਾਡਾ ਹਾਂਜੀ ਹਾਂਜੀ ਹਾਂਜੀ ਸਰ ਉਹਨਾਂ ਨੇ ਨੰਬਰ ਦਿੱਤਾ ਸੀਗਾ ਤੁਹਾਡਾ ਕੀ ਤੁਹਾਨੂੰ ਕਾਰਾਂ ਦੀ ਜਾਣਕਾਰੀ ਇਸ ਕਰਕੇ ਮੈਂ ਫੋਨ ਕਰ ਰਿਹਾ ਮੇਰੀ ਦਿੱਲੀ ਤੋਂ ਪੋਸਟਿੰਗ ਹੋਈ ਹੈ ਸਰ ਇੱਥੇ ਬੈਂਕ ਵਿੱਚ ਐੱਸ ਬੀ ਆਈ ਦੇ ਅਤੇ ਮੇਰਾ ਜੋ ਵਹੀਕਲ ਰਜਿਸਟ੍ਰੇਸ਼ਨ ਆ ਉਹ ਦਿੱਲੀ ਨੰਬਰ ਪਲੇਟ ਆ ਅਤੇ ਮੈਨੂੰ ਨਾ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਇੱਥੇ ਅਤੇ ਮੈਂ ਨਾ ਪੰਜਾਬ ਵਿੱਚ ਕਰਾਉਣੀ ਆ ਰਜਿਸਟ੍ਰੇਸ਼ਨ ਤੇ ਮੈਨੂੰ ਰਾਹੁਲ ਦੱਸ ਰਿਹਾ ਸੀਗਾ ਕਿ ਤੁਸੀਂ ਮਤਲਬ ਕਾਰਾਂ ਦੀ ਨੌਲੇਜ ਰੱਖਦੇ ਹੋ ਅਤੇ ਮੈਂ ਇਸੇ ਕਰਕੇ ਤੁਹਾਡਾ ਨੰਬਰ ਹਾਂਜੀ ਹਾਂਜੀ ਸਰ ਕੀ ਕੀ ਪ੍ਰੋਸੈਸ ਕੀ ਇਹਦਾ ਕੀ ਕੀ ਫੋਰਮੈਲਿਟੀਸ ਪੂਰੀਆਂ ਕਰਨੀਆਂ ਪੈਣਗੀਆਂ ਮੈਨੂੰ ਹਾਂਜੀ ਹਾਂਜੀ ਕੋਈ ਨਾ ਸਰ ਅਤੇ ਫੀਸ ਕਿੰਨੀ ਹੋਏਗੀ ਸਰ ਅੱਛਾ ਤੀਹ ਹਜ਼ਾਰ 'ਚ ਮੇਰਾ ਕੰਮ ਹੋ ਜਾਏਗਾ ਨਾ ਪੂਰਾ ਸਾਰਾ ਫਿਰ ਹਾਂਜੀ ਅਤੇ ਸਰ ਮੈਂ ਫਿਰ ਮਿਲਦਾ ਤੁਹਾਨੂੰ ਸ਼ਾਮ ਨੂੰ ਆ ਕੇ ਅੱਛਾ ਅੱਛਾ ਕੋਈ ਨਾ ਸਰ ਅਤੇ ਫਿਰ ਮੈਂ ਮਿਲਦੇ ਆ ਫਿਰ ਸ਼ਾਮ ਨੂੰ ਆ ਕੇ ਆਪਾਂ ਦੋਵੇਂ ਹਾਂ ਕੋਈ ਨਾ ਸਰ ਥੈਂਕ ਯੂ ਸਰ